ਹੈਲੋ ਸਤਿ ਸ਼੍ਰੀ ਅਕਾਲ ਸਰ ਸਰ ਤੁਸੀਂ ਟੈਕਨੀਸ਼ੀਅਨ ਬੋਲ ਰਹੇ ਹੋ ਸਰ ਮੈਂ ਨਾ ਦਰਅਸਲ ਕੰਪਿਊਟਰ 'ਚ ਆਪਣਾ ਚਲਾਇਆ ਸੀ ਉਹਦੇ 'ਚ ਦਿੱਕਤਾਂ ਆ ਰਹੀਆਂ ਨੇ ਉਨ੍ਹਾਂ ਦਾ ਸਲਿਊਸ਼ਨ ਚਾਹੀਦਾ ਸੀ ਸਰ ਕੀ ਤੁਸੀਂ ਮੈਨੂੰ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਸਲਿਊਸ਼ਨ ਉਨ੍ਹਾਂ ਦੇ ਸਰ ਬਹੁਤ ਪੁਰਾਣਾ ਮਤਲਬ ਮੋਡਲ ਤਾਂ ਅਗਜੇਕਟ ਨਹੀਂ ਨੋਲੇਜ ਮਤਲਬ ਆਈ ਥਰੀ ਹੈ ਸਰ ਜਨਰੇਸ਼ਨ ਵੀ ਕਾਫ਼ੀ ਡਾਊਨ ਜਰਨੇਸ਼ਨ ਵੀ ਸੈਵਨ ਜਰਨੇਸ਼ਨ ਹੈ ਕਾਫ਼ੀ ਡਾਊਨ ਸੈਵਨ ਜਰਨੇਸ਼ਨ ਅਤੇ ਮੈਨੂਫੈਕਚਰਿੰਗ ਵੀ ਇਹਦੀ ਸਰ ਟੂ ਥਾਉਜੈਂਡ ਥਰਟੀਨ ਫੋਰਟੀਨ ਦੇ ਅਪਰੋਕਸ ਆ ਆਪਣੇ ਜੀ ਡੈੱਲ ਦਾ ਪ੍ਰੋਬਲਮ ਸਰ ਜਿਵੇਂ ਹੁਣ ਮੈਂ ਜਦੋਂ ਸੋਲਡ ਵਰਕਸ ਜਾਂ ਆਟੋਕੈਟ ਕੋਈ ਰਨ ਕਰਦਾਂ ਕੋਈ ਇਹੋ ਜਿਹਾ ਪ੍ਰੋਗਰਾਮ ਰਨ ਕਰਦਾ ਓਦੋਂ ਉਹ 'ਚ ਬਹੁਤ ਜ਼ਿਆਦਾ ਲੈਗ ਇਸ਼ੂਸ ਆ ਰਹੇ ਨੇ ਕਈ ਵਾਰ ਪ੍ਰੋਪਰ ਵਰਕਿੰਗ ਨਹੀਂ ਹੁੰਦੀ ਆਪਣੇ ਆਪ ਐੱਪ ਬੰਦ ਹੋ ਜਾਂਦੀ ਹੈ ਦੁਬਾਰਾ ਡੈਕ ਮੇਨ ਸਕਰੀਨ 'ਤੇ ਚੱਲ ਜਾਂਦਾ ਹਾਂਜੀ ਸਰ ਹਾਂਜੀ ਨਹੀਂ ਸਰ ਗ੍ਰਾਫਿਕ ਕਾਰਡ ਤਾਂ ਨਹੀਂ ਹੈ ਗ੍ਰਾਫਿਕ ਕਾਰਡ ਸਰ ਮਤਲਬ ਹੁਣ ਮੈਂ ਕੀ ਕਰਾਂ ਇਹਦੇ ਵਿੱਚ ਹੀ ਇੰਸਟਾਲ ਕਰਵਾਵਾਂ ਹੋਰ ਕਿ ਕਿ ਮੈਨੂੰ ਹੋਰ ਵੀ ਸਪਪੈਸੀਫਿਕੇਸ਼ਨ ਹੋਰ ਚਾਹੀਦੀਆਂ ਨੇ ਜ਼ਿਆਦੇ ਨਹੀਂ ਸਰ ਪੀ ਸੀ ਹੈ ਹਾਂਜੀ ਸਰ ਸਰ ਇਹਦੇ ਵਿੱਚ ਹੀ ਇੰਸਟਾਲ ਹੋ ਜੂਗਾ ਇਸੇ ਬੋਡੀ 'ਚ ਕਿ ਆਪਾਂ ਨੂੰ ਸੀ ਪੀ ਯੂ ਵੀ ਨਵਾਂ ਹੀ ਲੈਣਾ ਪੈਣਾ ਸਰ ਕੋਈ ਆਈਡਿਆ ਵੀ ਕਿੰਨਾ ਕੁ ਖ਼ਰਚਾ ਆ ਜਾਂਦਾ ਜਾਂ ਨਵਾਂ ਕਿੰਨੇ ਕੁ ਦਾ ਹੁੰਦਾ ਡਿਫਰੈਂਸ ਇਨ੍ਹਾਂ ਦਾ

ਇਲੈਵਨ ਥਾਊਜੈਂਡ ਸਰ ਹਾਂਜੀ ਮਤਲਬ ਜੇ ਨਵਾਂ ਲਈਏ ਫ਼ੇਰ ਕਿੰਨੇ ਕ ਦਾ ਅਪਰੋਕਸ ਪੈਜੂ ਡੈੱਲ ਦਾ ਹਾਂਜੀ ਸਰ ਮਤਲਬ ਸਰ ਉਹਦੇ ਲਈ ਤਾਂ ਸਕਰੀਨ ਵੀ ਅਲੱਗ ਲੱਗੇਗੀ ਨਾ ਮੋ ਮੋਨੀਟਰ ਵੀ ਅਲੱਗ ਲੱਗੇਗਾ ਨਾ ਹਾਂਜੀ ਮਤਲਬ ਜੇ ਸਪੋਰਟ ਕਰਦਾ ਹੋਵੇਗਾ ਸੀ ਪੀ ਯੂ ਨੂੰ ਫ਼ੇਰ ਚੱਲ ਪੂਗਾ ਨਹੀਂ ਹਾਂਜੀ ਸਰ ਹਾਂਜੀ ਸਰ ਮਤਲਬ ਜੇ ਸਰ ਜਿਵੇਂ ਹੁਣ ਮੇਰਾ ਸੋਲਿਡ ਵਰਕ ਚੱਲ ਪਿਆ ਮਤਲਬ ਸੋਲਿਡ ਵਰਕ ਜੇ ਚੱਲ ਪਿਆ ਮੈਨੂੰ ਐਂ ਤਾਂ ਨਹੀਂ ਕੋਈ ਦਿੱਕਤ ਆਵੇਗੀ ਵੇ ਨਾਲ਼ ਦੀ ਨਾਲ਼ ਮੈਂ ਓਟੋਕੈਟ ਚਲਾ ਰਿਹਾਂ ਤਾਂ ਉਹ ਦੇ ਵਿੱਚ ਕੋਈ ਦਿੱਕਤ ਆਵੇ ਹਾਂਜੀ ਸਰ ਮਤਲਬ ਮੈਂ ਜੇ ਸੋਲਿਡ ਵੀ ਚ ਚੱਲੇਗਾ ਤਾਂ ਓਟੋਕੈਟ ਵੀ ਚੱਲੇਗੀ ਕੋਈ ਅ ਐਕਸਟਰਨਲ ਹੋਰ ਵੀ ਐੱਪਸ ਵੀ ਨਾਲ਼ ਦੀ ਨਾਲ਼ ਰਨ ਹੋ ਸਕਦੇ ਹੈ ਸਰ ਹਾਂਜੀ ਸਰ ਹਾਂਜੀ ਹਾਂਜੀ ਚਲੋ ਫ਼ੇਰ ਸਰ ਤੁਹਾਨੂੰ ਮੈਂ ਫਰਦਰ ਕੋਂਟੈਕਟ ਕਰੂੰਗਾ ਜੇ ਮੈਨੂੰ ਕੋਈ ਦਿੱਕਤ ਆਈ ਥੈਂਕ ਯੂ ਸਰ